ਹਾਂ ਮੈਂ ਯੋਗਾ ਦੀ ਕਲਾਸ ਲਗਾਈ ਹੈ ਯੋਗਾ ਦੀ ਕਲਾਸ ਵਿੱਚ ਸਾਨੂੰ ਜੇਕਰ ਅਸੀਂ ਕੋਈ ਗ਼ਲਤੀ ਕਰਦੇ ਹਾਂ ਤਾਂ ਸਾਨੂੰ ਉਸਨੂੰ ਸਹੀ ਕਰਨ ਲਈ ਇੱਕ ਯੋਗ ਗੁਰੂ ਹੁੰਦਾ ਹੈ ਪਰ ਜੇਕਰ ਅਸੀਂ ਇਹ ਹੀ ਯੋਗਾ ਘਰਾਂ ਕਰਦੇ ਹਾਂ ਤਾਂ ਸਾਡੀ ਗ਼ਲਤੀ 'ਤੇ ਸਾਨੂੰ ਕੋਈ ਸਹੀ ਕਰਨ ਵਾਲਾ ਨਹੀਂ ਹੁੰਦਾ